ਪਛਾਣ ਅਤੇ ਸੰਬੰਧਿਤੀ ਭਾਵਨਾ ਨੂੰ ਪ੍ਰਗਟ ਕਰਨ ਲਈ ਪੰਜਾਬ ਦੇ ਲੋਕ ਲੋਕ ਗੀਤ ਗਾਉਂਦੇ ਹਨ ਕਵਿਤਾਵਾਂ ਯੋਧਿਆਂ ਦੀਆਂ ਵਾਰਾਂ ਜਾਂ ਹੋਰ ਟੱਪੇ ਗਾਉਂਦੇ ਹਨ ਭੰਗੜਾ ਯਾਂ ਗਿੱਧਾ ਅਤੇ ਹੋਰ ਸਥਾਨਕ ਪਰੰਪਰਾ ਅਨੁਸਾਰ ਲੋਕ ਨਾਚ ਵੀ ਕਰਦੇ ਹਨ ਲੋਕ ਸਮੇਂ ਅਤੇ ਮੌਕਿਆਂ ਅਨੁਸਾਰ ਲੋਕ ਗੀਤ ਗਾਉਂਦੇ ਹਨ ਜਿਵੇਂ ਕਿ ਘੋੜੀਆਂ ਮੁੰਡੇ ਦੇ ਵਿਆਹ 'ਤੇ ਸੁਹਾਗ ਕੁੜੀ ਦੇ ਵਿਆਹ ਸਮੇਂ ਗਾਇਆ ਜਾਂਦਾ ਹੈ ਇਹਨਾਂ ਮੌਕਿਆਂ ਸਮੇਤ ਟੱਪੇ ਗਾਉਣ ਅਤੇ ਸਿੱਠਣੀਆ ਵੀ ਪ੍ਰਚਲਿਤ ਹਨ ਸੂਰਬੀਰਤਾ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਯੋਧਿਆਂ ਦੀਆਂ ਵਾਰਾਂ ਜਾਂ ਕਵਿਤਾਵਾਂ ਗਾਈਆਂ ਜਾਂਦੀਆਂ ਹਨ ਪੰਜਾਬ ਦੇ ਲੋਕ ਗੀਤ ਵਿੱਚ ਪੰਜਾਬ ਦੀ ਬੋਲਬਾਣੀ ਖਾਣ ਪੀਣ ਪਹਿਰਾਵਾ ਝਿਲਕਦਾ ਹੈ ਧਾਰਮਿਕ ਸਮਾਗਮਾਂ ਸਮੇਂ ਕੀਰਤਨ ਦਰਬਾਰ ਰਾਗ ਦਰਬਾਰ ਕਵੀ ਦਰਬਾਰ ਅਤੇ ਢਾਡੀ ਵਾਰਾ ਆਦਿ ਆਯੋਜਿਤ ਕੀਤੇ ਜਾਂਦੇ ਹਨ